ਸਾਡੇ ਖੇਤਰ ਵਿੱਚ ਜਿਹੜੀਆਂ ਮੁੱਖ ਸਿਆਸੀ ਪਾਰਟੀਆਂ ਨੇ ਉਹਦੇ ਵਿੱਚ ਜੀ ਕਾਂਗਰਸ ਹੈ ਅਤੇ ਅਕਾਲੀ ਦਲ ਹੈ ਜਿੱਦਾਂ ਆਪ ਹੈ ਆਪ ਸਰਕਾਰ ਹੈ ਅਤੇ ਇਹ ਇਸ ਤਰ੍ਹਾਂ ਕਿ ਵਿਕਸਿਤ ਕਿਸ ਤਰ੍ਹਾਂ ਹੋਈਆਂ ਕਿ ਕਾਂਗਰਸ ਔਰ ਜਿਹੜਾ ਅਕਾਲੀ ਦਲ ਹੈ ਪਿਛਲੇ ਪੱਚੀ ਕੁ ਸਾਲ ਤੋਂ ਆ ਜਿਹੜਾ ਉਹ ਪੰਜਾਬ ਦੇ ਵਿੱਚ ਇਹਦਾ ਜਿਹੜਾ ਸਰਕਾਰਾਂ ਚੱਲਦੀਆਂ ਨੇ ਅਕਾਲੀ ਦਲ ਨੇ ਕਾਫੀ ਜ਼ਿਆਦਾ ਪੰਜਾਬ ਦੇ ਵਿੱਚ ਕੰਮ ਕੀਤੇ ਪੰਜਾਬ ਉਸੇ ਦੌਰਾਨ ਵਿਕਸਿਤ ਹੋਇਆ ਪਰ ਹੁਣ ਜਿਹੜੇ ਲਾਸਟ ਪੰਜ ਸਾਲ ਸੀ ਇਹਨਾਂ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਬਹੁਤੇ ਜ਼ਿਆਦਾ ਕੰਮ ਨਹੀਂ ਹੋਏ ਰਿਸ਼ਵਤ ਖੋਰੀ ਬਹੁਤ ਜ਼ਿਆਦਾ ਹੋ ਗਈ ਸਰਕਾਰੀ ਜਿਹੜੀ ਨੌਕਰੀਆਂ ਸੀ ਉਹ ਨਹੀਂ ਸੀ ਮਿਲ ਰਹੀਆਂ ਬੱਚੇ ਨੇ ਜਿਹੜੇ ਜ਼ਿਆਦਾ ਤੋਂ ਜ਼ਿਆਦਾ ਉਹ ਵਿਦੇਸ਼ਾਂ ਨੂੰ ਜਾ ਰਹੇ ਨੇ ਪਰ ਪਿਛਲੇ ਜਦੋਂ ਆਪ ਸਰਕਾਰ ਪੰਜਾਬ ਦੇ ਵਿੱਚ ਆਈ ਆ ਉਸ ਤੋਂ ਬਾਅਦ ਆ ਜਿਹੜਾ ਸਰਕਾਰੀ ਢਾਂਚਾ ਜਿਹੜਾ ਉਹਦੇ ਵਿੱਚ ਕਾਫੀ ਸਾਰੀਆਂ ਨੇ ਜਿਹੜੀਆਂ ਸਾਨੂੰ ਸਮੱਸਿਆਵਾਂ ਦੇ ਹੱਲ ਹੋਏ ਅਸੀਂ ਮਹਿਸੂਸ ਕਰਦੇ ਹਾਂ ਤਾਂ ਇੱਕ ਤਾਂ ਨੌਕਰੀਆਂ ਦੇ ਵਿੱਚ ਕਾਫੀ ਵਾਧਾ ਹੋਇਆ ਦੂਜਾ ਜਿਹੜੀ ਰਿਸ਼ਵਤ ਖੋਰੀ ਆ ਉਸ ਨੂੰ ਠੱਲ੍ਹ ਪਈ ਆ ਅਤੇ ਬਾ ਕਾਫੀ ਸਾਰੀਆਂ ਜਿਹੜੀਆਂ ਸੁੱਖ ਸਹੂਲਤਾਂ ਨੇ ਉਹ ਸਾਨੂੰ ਆਪ ਸਰਕਾਰ ਦੇ ਵੱਲੋਂ ਮਿਲੀਆਂ ਨੇ ਜੀ